ਵਿਗਿਆਪਨ ਰਾਹੀਂ ਸਾਨੂੰ ਜੋ ਵੀ ਬੱਚਤ ਕਰਨੇ ਦੀ ਸਿੱਖਿਆ ਮਿਲਦੀ ਹੈ ਉਸ ਨੂੰ ਬੱਚੇ ਵੀ ਸਿਆਣੇ ਵੀ ਸਭ ਆਪਣੀ ਬੱਚਤ ਕਰਕੇ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਨੂੰ ਤਰੱਕੀ ਦੀ ਰਾਹ 'ਤੇ ਲਿਜਾ ਸਕਦੇ ਹਨ ਤਾਂ ਜੋ ਉਹਨਾਂ ਦਾ ਵਿਗਿਆਪਨ ਦਾ ਫਾਇਦਾ ਲੈ ਕੇ ਵੱਧ ਤੋਂ ਵੱਧ ਬੱਚਤ ਕਰਨ ਦੀ ਆਦਤ ਪਾ ਸਕੀਏ